ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਵਿੱਚ ਮੁੱਖ ਸੱਭਿਆਚਾਰਕ ਅੰਤਰ ਭਾਸ਼ਾ ਭੋਜਨ ਅਤੇ ਕੱਪੜੇ ਮੌਸਮ ਆਦਿ ਰਾ ਤਾਂ ਬਹੁਤ ਹੈ ਭਾ ਉੱਤਰੀ ਭਾਰਤ ਦੇ ਵਿੱਚ ਭਾਸ਼ਾ ਅਤੇ ਭੋਜਨ ਕੱਪੜੇ ਹੋਰ ਮਤਲਬ ਤਰੀਕੇ ਨਾਲ ਚੇਂਜ ਕਰਕੇ ਪਾਏ ਜਾਂਦੇ ਹਨ ਜਦਕਿ ਦੱਖਣੀ ਭਾਰਤ ਦੇ ਵਿੱਚ ਹੋਰ ਢੰਗ ਨਾਲ ਪਾਏ ਜਾਂਦੇ ਦੱਖਣੀ ਭਾਰਤ ਵਿੱਚ ਭਾਸ਼ਾ ਦਾ ਲੱਗ ਪੀਓ ਕੀਤਾ ਜਾਂਦਾ ਹੈ ਹਿੰਦੀ ਦਾ ਜ਼ਿਆਦਾ ਕੀਤਾ ਜਾਂਦਾ ਅਤੇ ਜਿਹੜਾ ਉੱਤਰੀ ਭਾਰਤ ਹੁੰਦਾ ਉਸ ਦੇ ਵਿੱਚ ਭਾ ਮਤਲਬ ਭਾਸ਼ਾ ਦਾ ਅਲੱਗ ਵਿਸ਼ੇ ਭਾਸ਼ਾ ਵਰਤੀ ਜਾਂਦੀ ਭੋਜਨ ਦੇ ਮਾਮਲੇ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਭੋਜਨ ਦਾ ਵੀ ਅਲੱਗ ਉਹ ਹੈ ਕੱਪੜਿਆਂ ਦਾ ਮੌਸਮ ਰਾਜਨੀਤੀ ਸਾਖਰਤਾ ਭੂਗੋਲ ਮੌਕੇ ਆਦਿ ਹਨ

ਭਾ ਦੱਖਣੀ ਭਾਰਤ ਦੇ ਵਿੱਚ ਭਾਸ਼ਾ ਦਾ ਭੋਜਨ ਦਾ ਕੱਪੜੇ ਦਾ ਅਲੱਗ ਤੋਂ ਢੰਗ ਹੈ ਭੂਗੋਲ ਦੇ ਵਿੱਚ ਦੱਖਣੀ ਭਾਰਤ ਦੇ ਵਿੱਚ ਦਰੱਖਤ ਜ਼ਿਆਦਾ ਹਨ ਮੌਕੇ ਵੀ ਜ਼ਿਆਦਾ ਹਨ ਅਤੇ ਮੌਸਮ ਦਾ ਵੀ ਬਹੁਤ ਜ਼ਿਆਦਾ ਫਰਕ ਹੈ ਜਦਕਿ ਉੱਤਰੀ ਭਾਰਤ ਦੇ ਵਿੱਚ ਮੌਸਮ ਥੋੜ੍ਹਾ ਗਰਮ ਰਹਿੰਦਾ ਹੈ ਥੋੜ੍ਹਾ ਪਹਾੜੀ ਠੰਡਾ ਰਹਿੰਦਾ ਹੈ ਅਤੇ ਮਤਲਬ ਠੀਕ ਰਹਿੰਦਾ ਹੈ ਮੌਸਮ ਦੇ ਹਿਸਾਬ ਨਾਲ ਚੇਂਜ ਹੁੰਦਾ ਰਹਿੰਦਾ ਹੈ ਜਦਕਿ ਉੱਤਰੀ ਭਾਰਤ ਦੇ ਵਿੱਚ ਥੋੜ੍ਹਾ ਜ਼ਿਆਦਾ ਹੁੰਦਾ ਹੈ ਕਿ ਉੱਧਰ ਪਹਾੜੀ ਇਲਾਕੇ ਕਰਕੇ ਮੌਸਮ ਉੱਥੇ ਜ਼ਿਆਦਾ ਵਧੀਆ ਰ